ਮੈਂ ਪਟਰੋਲ ਪੰਪ ਕਰਿਆਨਾ ਸਟੋਰ ਅਤੇ ਅਜਿਹੇ ਹੋਰ ਥਾਵਾਂ ਉੱਤੇ ਕੇਵਲ ਨਗਦ ਭੁਗਤਾਨ ਕਰਨਾ ਹੀ ਪਸੰਦ ਕਰਦਾ ਹਾਂ ਕਿਉਂਕਿ ਮੈਂ ਇੰਟਰਨੈਟ ਉੱਤੇ ਕੀਤੇ ਗਏ ਨ ਪੈਸਿਆਂ ਦੀ ਲੈਣ ਦੇਣ ਦੀ ਵਿਵਸਥਾ ਉੱਤੇ ਜ਼ਿਆਦਾ ਭਰੋਸਾ ਨਹੀਂ ਕਰਦਾ ਹਾਂ ਜੇਕਰ ਮੈਨੂੰ ਲੋੜ ਪੈਂਦੀ ਹੈ ਜਾਂ ਮੇਰੇ ਕੋਲ ਨਕਦ ਪੈਸੇ ਦੇਣ ਦੀ ਵਿਵਸਥਾ ਨਹੀਂ ਹੈ ਤਾਂ ਜ਼ਰੂਰ ਮੈਂ ਇੰਟਰਨੈੱਟ ਦੀ ਦੇ ਉੱਤੇ ਪੈਸੇ ਭੇਜਣ ਦੇ ਦੀ ਵਿਵਸਥਾ ਦਾ ਇਸਤੇਮਾਲ ਕਰੂੰਗਾ ਇੰਟਰਨੈਟ ਨੇ ਪੈਸੇ ਲੈਣ ਦੇਣ ਦੇ ਸੰਕਲਪ ਨੂੰ ਬਹੁਤ ਹੱਦ ਤੱਕ ਬਦਲ ਦਿੱਤਾ ਹੈ ਲੋਕ ਅੱਜ ਦੇ ਸਮੇਂ ਵਿੱਚ ਬਿਨ੍ਹਾਂ ਪੈਸਿਆਂ ਦੇ ਨਾਲ ਪੈਸਿਆਂ ਦੇ ਹੀ ਨਗਦ ਪੈਸਿਆਂ ਦੇ ਹੀ ਇੰਟਰਨੈਟ ਦੁਆਰਾ ਹੀ ਭੁਗਤਾਨ ਕਰ ਦਿੰਦੇ ਹਨ ਅਤੇ ਇਸ ਦੇ ਨਾਲ ਕਾਫ਼ੀ ਮਦਦ ਮਿਲਦੀ ਹੈ ਜਿਵੇਂ ਕਿ ਲੋਕਾਂ ਨੂੰ ਬਹੁਤ ਸਾਰਾ ਕੈਸ਼ ਕੈਰੀ ਨਹੀਂ ਕਰਨਾ ਪੈਂਦਾ ਜਿਵੇਂ ਕਿ ਜੇਕਰ ਅਸੀਂ ਕਿਤੇ ਦੂਰ ਟਰੈਵਲ ਕਰ ਰਹੇ ਹਾਂ ਜਾਂ ਅਸੀਂ ਕਿਤੇ ਜ਼ਰੂਰੀ ਕੰਮ ਲਈ ਪੈਸੇ ਖਰਚਣੇ ਹਨ ਜਾਂ ਅਸੀਂ ਕੋਈ ਘਰ ਦੀ ਚੀਜ਼ ਲੈਣੀ ਹੈ ਜਿਵੇਂ ਕਿ ਫਰਿਜ ਟੀ ਵੀ ਆਦਿ ਇੱਦਾਂ ਦੀਆਂ ਚੀਜ਼ਾਂ ਲਈ ਸਾਨੂੰ ਕੈਸ਼ ਇੰਨਾ ਜ਼ਿਆਦਾ ਕੈਸ਼ ਦੇਣ ਦੀ ਲੋੜ ਨਹੀਂ ਪੈਂਦੀ ਅਸੀਂ ਉਸਦਾ ਅਸੀਂ ਆਨਲਾਈਨ ਹੀ ਭੁਗਤਾਨ ਕਰ ਸਕਦੇ ਹਾਂ ਜੋ ਕਿ ਬਹੁਤ ਇੱਕ ਆਸਾਨ ਤਰੀਕਾ ਹੈ ਅਤੇ ਸਾਨੂੰ ਜ਼ਿਆਦਾ ਕੈਸ਼ ਕੈਰੀ ਕਰਨ ਦੀ ਜਾਂ ਜ਼ਿਆਦਾ ਕੈਸ਼ ਨਾਲ ਰੱਖਣ ਦੀ ਲੋੜ ਨਹੀਂ ਪੈਂਦੀ ਅ ਅਜੋਕੇ ਸਮੇਂ ਵਿੱਚ ਲੋਕ ਜ਼ਿਆਦਾਤਰ ਆਨਲਾਈਨ ਪੈਸੇ ਪੇ ਕਰਨਾ ਹੀ ਪਸੰਦ ਕਰਦੇ ਹਨ ਅਤੇ ਲੋਕ ਇਸ ਉੱਪਰ ਬਹੁਤ ਵਿਸ਼ਵਾਸ ਕਰਦੇ ਹਨ ਪਰ ਇੰਟਰਨੈਟ ਦੇ ਉੱਤੇ ਪੈਸੇ ਦੀ ਲੈਣ ਦੇਣ ਦੀ ਵਿਵਸਥਾ ਦੇ ਕੀ ਨੁਕਸਾਨ ਵੀ ਹਨ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਲੋਕਾਂ ਨਾਲ ਬਹੁਤ ਫਰੋਡ ਹੋਏ ਨੇ ਅਤੇ ਕਈ ਵਾਰ ਪੈਸੇ ਗਲਤ ਜਗ੍ਹਾ ਵੀ ਪਹੁੰਚ ਜਾਂਦੇ ਹਨ ਪਰ ਜੋ ਕਿ ਇੱਕ ਬਹੁਤ ਅਨੋਖਾ ਕੇਸ ਹੀ ਹੁੰਦੇ ਹਨ ਜਿਹਨਾਂ ਵਿੱਚ ਇਹੋ ਜਿਹਾ ਹੁੰਦਾ ਪਰ ਜ਼ਿਆਦਾਤਰ ਇੰਟਰਨੈਟ ਇੱਕ ਬਹੁਤ ਹੀ ਸਾਹਿਤਕ ਚੀਜ਼ ਹੈ ਜਿਸ ਨਾਲ ਅਸੀਂ ਪੈਸੇ ਦੀ ਲੈਣ ਦੇਣ ਬਹੁਤ ਆਸਾਨ ਤਰੀਕੇ ਨਾਲ ਕਰ ਸਕਦੇ ਹਾਂ